ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰਵੀਰ ਸਿੰਘ ਬੋਲ ਰਿਹਾ ਤੁਸੀਂ ਲਵਿਸ਼ ਰੈਸਟੋਰੈਂਟ ਥਰਟੀ ਨਾਈਨ ਤੋਂ ਬੋਲ ਰਹੇ ਹੋ ਅਤੇ ਮੈਂ ਤੁਹਾਨੂੰ ਲੰਚ ਦੇ ਵਿੱਚ ਤਿੰਨ ਚਾਰ ਆਈਟਮਾਂ ਜਿਵੇਂ ਕੜਾਹੀ ਪਨੀਰ ਸ਼ਾਹੀ ਪਨੀਰ ਅਤੇ ਮਿਕਸ ਵੈੱਜ ਅਤੇ ਦਾਲ ਮੱਖਣੀ ਅਤੇ ਬਟਰ ਨਾਨ ਔਡਰ ਕੀਤੇ ਸੀਗੇ ਤਕਰੀਬਨ ਅੱਧਾ ਘੰਟਾ ਹੋ ਗਿਆ ਮੇਰੇ ਘਰ ਰਿਸ਼ਤੇਦਾਰ ਪਹੁੰਚਣ ਵਾਲੇ ਆ ਅਤੇ ਹੁਣ ਤੱਕ ਡਿਲੀਵਰੀ ਬਹੁਤ ਜ਼ਿਆਦਾ ਲੇਟ ਹੋ ਗਈ ਤੁਹਾਡੀ ਹੁਣ ਤੱਕ ਮੇਰੇ ਘਰ ਲੰਚ ਦਾ ਸਮਾਨ ਨਹੀਂ ਪਹੁੰਚਿਆ ਕਿਰਪਾ ਕਰਕੇ ਮੈਨੂੰ ਜਲਦੀ ਤੋਂ ਜਲਦੀ ਲੰਚ ਦਾ ਸਮਾਨ ਮੇਰੇ ਘਰ ਪਹੁੰਚਾ ਦਿਉ ਕਿਉਂਕਿ ਮੇਰੇ ਰਿਸ਼ਤੇਦਾਰ ਰਸਤੇ ਦੇ ਵਿੱਚ ਹੈ ਅਤੇ